ਮੇਰੇ ਘਰ ਵਿੱਚ ਵੈਸੇ ਤਾਂ ਚੌਵੀ ਘੰਟੇ ਬਿਜਲੀ ਆਉਂਦੀ ਹੈ ਪਰ ਜਿਵੇਂ ਬਰਸਾਤ ਦੇ ਮੌਸਮ ਵਿੱਚ ਬਿਜਲੀ ਦੇ ਕੱਟ ਲੱਗ ਜਾਂਦੇ ਹਨ ਅਤੇ ਉਹ ਬਹੁਤ ਪ੍ਰੇਸ਼ਾਨ ਕਰਦੇ ਹਨ ਗਰਮੀ ਦੇ ਮੌਸਮ ਵਿੱਚ ਕੱਟ ਲੱਗਣ ਕਾਰਨ ਜਦੋਂ ਏ ਸੀ ਬੰਦ ਹੁੰਦਾ ਹੈ ਜਾਂ ਕੂਲਰ ਬੰਦ ਹੁੰਦੇ ਹਨ ਤਾਂ ਫਿਰ ਤਾਂ ਬਹੁਤ ਹੀ ਔਖਾ ਹੋ ਜਾਂਦਾ ਅਤੇ ਬਹੁਤ ਗਰਮੀ ਦੇ ਨਾਲ ਪ੍ਰੇਸ਼ਾਨੀ ਹੁੰਦੀ ਹੈ ਪਸੀਨੇ ਚੋਂਦੇ ਹਨ ਅਤੇ ਕੰਮ ਕਰਨਾ ਤਾਂ ਬਹੁਤ ਔਖਾ ਹੋ ਜਾਂਦਾ ਹੈ